ਹਾਂਜੀ ਕਾਨੂੰਨ ਪ੍ਰਣਾਲੀ ਜਿਹੜੀ ਆ ਹਰੇਕ ਦੀ ਸਹਾਇਤਾ ਕਰਦਾ ਜਿੱਦਾਂ ਜੇਲ ਵਿਚ ਬੈਠੇ ਕੈਦੀਆਂ ਦੀ ਵੀ ਸਹਾਇਤਾ ਕਰਦਾ ਵਾ ਬਾਰ ਵਿੱਚ ਬਾਹਰ ਜਿਹੜੇ ਕਾਨੂੰਨ ਬਣਾਏ ਗਏ ਹੈ ਉਹਨਾਂ ਦਾ ਵੀ ਅਨੁਸ਼ਾਸ਼ਨ ਦੀ ਪਾਲਣਾ ਪੂਰੀ ਕਰਦਾ ਵਾ ਹਰੇਕ ਨੂੰ ਮਤਲਬ ਕਿ ਕਾਨੂੰਨ ਜਿਹੜਾ ਵਾ ਹਰੇਕ ਦੀ ਸਹਾਇਤਾ ਕਰਦਾ ਵਾ ਮਤਲਬ ਕਿ ਜਿਹੜਾ ਫ਼ੈਸਲਾ ਵਾ ਉਹ ਹਰੇਕ ਦੇ ਜਿਹਦੇ ਪੱਖ ਵਿੱਚ ਹੁੰਦਾ ਉਹਦੇ ਪੱਖ ਵਿੱਚ ਬੋਲਦਾ ਵਾ ਚੋਰੀਆਂ ਗੈਸਟਰਾਂ ਨੂੰ ਸਮੇਂ ਸਿਰ ਫੜ ਲੈਂਦਾ ਵਾ ਚੋਰਾਂ ਨੂੰ ਸਮੇਂ ਸਿਰ ਫੜਦਾ ਵਾ ਸਮੇਂ ਸਿਰ ਛਾਪੇ ਛਾਪੇ ਮਾਰਦੀ ਹੈ ਜਿਹੜੇ ਕਿ ਸ਼ਰਾਬ ਅਲਕੋਲ ਵੇਚਦੇ ਹਨ ਉਹਨਾਂ ਦੀ ਠੇਕਿਆਂ 'ਤੇ ਵੀ ਛਾਪੇ ਮਾਰਦੀ ਆ ਜਿਹੜੇ ਵੀ ਗੈਰ ਕਾਨੂੰਨੀ ਕੰਮ ਕਰਦੇ ਹਨ ਉਹਨਾਂ ਨੂੰ ਵੀ ਕਾਨੂੰਨ ਜਿਹੜਾ ਵਾ ਆਪਣੇ ਕਾਨੂੰਨ ਨਾਲ ਉਹਨਾਂ ਨੂੰ ਸਜਾ ਦਿੰਦਾ ਵਾ ਆਪਣੇ ਮਤਲਬ ਕਿ ਉਹਨਾਂ ਨੂੰ ਦੱਸਦਾ ਵੀ ਤੁਸੀਂ ਇਹ ਕੰਮ ਨਾ ਕਰੋ ਅਤੇ ਜਿਹੜਾ ਵੀ ਉਹ ਲੋਕਾਂ ਨੂੰ ਦੱਸਦੇ ਹੈ ਵੀ ਕਾਨੂੰਨ ਜਿਹੜੇ ਮਤਲਬ ਅਨੁਸ਼ਾਸ਼ਨ ਆਪਣੇ ਪੰਜਾਬ ਵਿੱਚ ਅਨੁਸ਼ਾਸ਼ਨ ਨੂੰ ਕਾਇਮ ਰੱਖਦਾ ਵਾ ਹਰੇਕ ਦੀ ਸਹਾਇਤਾ ਕਰਦਾ ਵਾ ਚੋਰੀਆਂ ਡਾਕਿਆਂ ਹਰੇਕ ਚੀਜ਼ ਤੋਂ ਮਤਲਬ ਕਿ ਜੋ ਵੀ ਆਪਣੀ ਕਾਨੂੰਨ ਜੋ ਵੀ ਸਰਕਾਰ ਨੇ ਆਪਾਂ ਨੂੰ ਕਾਨੂੰਨ ਦਿੱਤੇ ਆ ਉਨ੍ਹਾਂ ਦੀ ਕਾਨੂੰਨ ਜਿਹੜਾ ਵਾ ਉਹ ਪਾਲਣਾ ਕਰਦਾ ਵਾ ਅਤੇ ਹਰੇ ਮਤਲਬ ਹਰੇਕ ਵਿਅਕਤੀ ਨੂੰ ਉਹ ਇਹ ਨਹੀਂ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦਾ ਐਕਸੀਡੈਂਟ ਜਿੱਥੇ ਜਿਹਦਾ ਵੀ ਹੁੰਦਾ ਵਾ ਉੱਥੇ ਪੁਲਿਸ ਪਹੁੰਚ ਕੇ ਉਹਦੀ ਜਾਂਚ ਪੜਤਾਲ ਵੀ ਕਰਦੀ ਹੈ ਕਾਨੂੰਨ ਪਾਸ ਕਾਨੂੰਨ ਜਿਹੜਾ ਵਾ ਆਪਣੇ ਅਨੁਸ਼ਾਸ਼ਨ ਨੂੰ ਕਾਇਮ ਰੱਖਦਾ ਵਾ